ਸੰਗੀਤ ਦੀ ਸ਼ੈਲੀ ਹੀ ਮੇਰੀ ਪਸੰਦੀਦਾ ਸ਼ੈਲੀ ਹੈ ਪਰ ਹਾਂ ਸੰਗੀਤ ਦੀ ਸ਼ੈਲੀਆਂ ਵਿੱਚੋਂ ਮੈਨੂੰ ਗੁਰਬਾਣੀ ਦਾ ਕੀਰਤਨ ਕਰਨਾ ਬੜਾ ਵਧੀਆ ਲੱਗਦਾ ਕਿਉਂਕਿ ਮੈਂ ਬਚਪਨ ਤੋਂ ਹੀ ਗੁਰਬਾਣੀ ਦਾ ਕੀਰਤਨ ਕਰਦੀ ਆ ਰਹੀ ਹਾਂ ਹਾਂ ਮੈਂ ਜੋ ਸੰਗੀਤ ਦੀ ਸਿੱਖਿਆ ਲਈ ਸੀ ਉਹ ਵੀ ਗੁਰਬਾਣੀ ਨੂੰ ਸਿੱਖਣ ਨੂੰ ਗੁਰਬਾਣੀ ਨੂੰ ਪੜ੍ਹਨ ਵਾਸਤੇ ਹੀ ਲਈ ਸੀ ਲੇਕਿਨ ਜੇਕਰ ਆਪਾਂ ਗੱਲ ਕਰੀਏ ਤਾਂ ਲੋਕ ਗੀਤਾਂ ਦੇ ਲੋਕ ਗੀਤ ਵੀ ਮੈਨੂੰ ਗਾਣੇ ਬੜੇ ਪਸੰਦ ਨੇ ਉਹਨਾਂ ਦੇ ਵਿੱਚ ਟੱਪੇ ਜਿਹੜੇ ਹੈ ਟੱਪਿਆਂ ਨੂੰ ਟੱਪੇ ਮੈਨੂੰ ਬਹੁਤ ਪਸੰਦ ਹੈ ਮਤਲਬ ਮੈਂ ਇੱਕ ਟੱਪਾ ਤੁਹਾਨੂੰ ਗਾ ਕੇ ਸੁਣਾਉਂਦੀ ਹਾਂ

ਇਸ ਤਰ੍ਹਾਂ ਮੈਨੂੰ ਬਹੁਤ ਸਾਰੇ ਟੱਪੇ ਯਾਦ ਨੇ ਕੀਰਤਨ ਮੈਂ ਕਰਦੀ ਰਹਿੰਦੀ ਹਾਂ ਵਿਹਲੇ ਟਾਈਮ ਦੇ ਵਿੱਚ ਵੀ ਗਾਉਣਾ ਮੈਨੂੰ ਬਹੁਤ ਪਸੰਦ ਹੈ ਬਸ ਏਂ ਇਹਦੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਧੰਨਵਾਦ